ਪੰਜਾਬੀ ਦੇ ਵਿੱਚ ਲੇਖਕ ਜਾਂ ਕਵੀਆਂ ਦੀ ਜਾਂ ਗੱਲ ਕੀਤੀ ਜਾਵੇ ਜੇਕਰ ਤਾਂ ਬਹੁਤ ਸਾਰੇ ਲੇਖਕ ਅਤੇ ਕਵੀ ਇਹੋ ਜਿਹੇ ਨੇ ਜੋ ਮੇਰੀ ਆਪਣੀ ਪਸੰਦ ਦੇ ਨੇ ਪਰ ਫਿਰ ਵੀ ਇੱਕ ਕਵੀ ਜੋ ਸ਼ਿਵ ਕੁਮਾਰ ਬਟਾਲਵੀ ਹੈ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਬਹੁਤ ਜ਼ਿਆਦਾ ਸੁਣਦੀ ਹਾਂ ਕਿਉਂਕਿ ਉਹਨੂੰ ਬਿਰਹਾ ਦਾ ਕਵੀ ਜਾਂ ਦਰਦਾਂ ਦਾ ਕਵੀ ਵੀ ਕਿਹਾ ਜਾਂਦਾ ਹੈ ਉਹ ਬੜੀ ਆਪਣੀ ਬਿਰਹਾ ਜਿਹੜੀ ਹੈ ਉਹ ਆਪਣੇ ਸ਼ਬਦਾਂ ਰਾਹੀਂ ਆਪਣੇ ਹੰਝੂਆਂ ਨੂੰ ਆਪਣੇ ਸਾਹਮਣੇ ਬਿਆਨ ਕਰਦੇ ਨੇ ਕਿ ਕਿੰਨਾ ਉਹਨਾਂ ਦੇ ਅੰਦਰ ਉਹ ਦਰਦ ਸੀ ਉਹ ਬਿਰਹਾ ਸੀ ਜਿਹੜੀਆਂ ਉਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਝਲਕਦਾ ਆ ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਕੁਛ ਸੱਚਾਈ ਦੇ ਆਧਾਰਤ ਵੀ ਉਹਨਾਂ ਦੀਆਂ ਕਵਿਤਾਵਾਂ ਨੇ ਜਿਨ੍ਹਾਂ ਨੂੰ ਸੁਣ ਕੇ ਬੜਾ ਸਕੂਨ ਮਨ ਨੂੰ ਮਿਲਦਾ ਆ ਅਤੇ ਸੁਣਨ ਵਿੱਚ ਵੀ ਬਹੁਤ ਚੰਗਾ ਲੱਗਦਾ ਅਤੇ ਮੈਂਟਲੀ ਤੌਰ 'ਤੇ ਆਪਾਂ ਜਿਹੜੇ ਆ ਉਹ ਫਰੈਸ਼ ਹੋ ਜਾਂਦੇ ਹਾਂ ਸੋ ਉਹਨਾਂ ਨੇ ਮਤਲਬ ਕਿ ਪੰਜਾਬ ਦੇ ਜੀਵਨ ਨੂੰ ਪੰਜਾਬ ਦੀ ਸੱਚਾਈ ਨੂੰ ਵੀ ਆਪਣੀਆਂ ਕਵਿਤਾ ਰਾਹੀਂ ਦਰਸਾਇਆ ਅਤੇ ਲੋਕਾਂ ਦੇ ਸਾਹਮਣੇ ਰੱਖਿਆ ਉਹਨਾਂ ਦੇ ਕੰਮ ਤਾਂ ਬਹੁਤ ਨੇ ਕਿਉਂਕਿ ਸਭ ਤੋਂ ਵੱਡਾ ਕੰਮ ਉਹਨਾਂ ਦਾ ਇਹ ਹੈ ਕਿ ਪੰਜਾਬੀ ਜਿਹੜਾ ਇਤਿਹਾਸ ਆ ਸਾਹਿਤ ਆ ਉਹਦੇ ਵਿੱਚ ਉਹਨਾਂ ਦੀ ਬੜੀ ਵਡਮੁੱਲੀ ਦੇਣ ਹੈ ਸ਼ਿਵ ਕੁਮਾਰ ਬਟਾਲਵੀ ਦੀ ਉਹ ਇੱਕ ਬਹੁਤ ਹੀ ਮਸ਼ਹੂਰ ਅਤੇ ਬਹੁਤ ਹੀ ਮਤਲਬ ਕਿ ਉੱਚ ਸੋਚ ਵਾਲੇ ਜਿਹੜੇ ਕਵੀ ਹੋਏ ਨੇ ਜਿਨ੍ਹਾਂ ਨੇ ਸਾਡੇ ਪੰਜਾਬੀ ਸਾਹਿਤ ਨੂੰ ਦਾ ਸਿਰ ਬਹੁਤ ਉੱਚਾ ਕੀਤਾ ਆ ਪਰ ਬਦਕਿਸਮਤੀ ਨਾਲ ਉਹਨਾਂ ਦੀ ਉਮਰ ਇੰਨੀ ਨਹੀਂ ਸੀ ਪਰ ਉਹ ਛੋਟੀ ਉਮਰ ਵਿੱਚ ਹੀ ਉਹ ਇੰਨੀਆਂ ਕਵਿਤਾਵਾਂ ਸਾਨੂੰ ਲਿਖ ਕੇ ਦੇ ਗਏ ਨੇ ਜਾਂ ਇੰਨਾ ਕੁਛ ਇੰਨਾ ਦਰਦ ਇੰਨੀ ਸੱਚਾਈ ਪੰਜਾਬ ਦੀ ਉਹ ਦੇ ਗਏ ਨੇ ਲਿਖ ਕੇ ਕਿ ਸਾਨੂੰ ਜਿਹੜਾ ਉਹ ਜੀਵਨ ਭਰ ਹੀ ਉਹ ਜਿਹੜੀਆਂ ਯਾਦ ਰਹਿਣਗੀਆਂ ਜੇ ਅਸੀਂ ਉਹਨਾਂ ਨੂੰ ਸਹੀ ਮਨ ਨਾਲ ਸੁਣਦੇ ਹਾਂ ਸੋ ਸ਼ਿਵ ਕੁਮਾਰ ਬਟਾਲਵੀ ਜਿਹੜੇ ਨੇ ਉਹ ਇੱਕ ਪੰਜਾਬ ਦੇ ਬਹੁਤ ਵਧੀਆ ਅਤੇ ਉੱਘੇ ਪ੍ਰਸਿੱਧ ਕਵੀ ਹੋਏ ਨੇ ਧੰਨਵਾਦ